ਚਿੱਤਰਕਾਰੀ ਸ਼ੁਰੂ ਕਰਨ ਵਾਲਿਆਂ ਲਈ ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਚਿੱਤਰਕਾਰੀ ਹੈ ਜੋ ਬਹੁਤ ਹੀ ਨੇਕ ਦਿਲੀ ਕੰਮ ਆ ਬਹੁਤ ਦਿਮਾਗ ਆਉਣ ਵਾਲਾ ਕੰਮ ਆ ਇਹ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਵੀ ਜਣਾ ਖਣਾ ਚਿੱਤਰਕਾਰ ਬਣ ਗਿਆ ਵੀ ਬ ਫੋਟੋ ਬਣਾ ਤੀ ਉਹ ਕਰਤੇ ਉਹ ਕਰਤੀ ਚਿੱਤਰਕਾਰੀ ਤਾਂ ਚਿੱਤਰਕਾਰ ਉਸ ਨੂੰ ਕਿਹਾ ਜਾਊਗਾ ਜੋ ਹੂ ਬ ਹੂ ਸਾਹਮਣੇ ਦੇਖੀ ਹੋਈ ਚੀਜ਼ ਨੂੰ ਹੂ ਬ ਹੂ ਬਣਾ ਦੇਵੇ ਉਹ ਹੋਊ ਚਿੱਤਰਕਾਰ ਜਿੱਦਾਂ ਕਿ ਇੱਕ ਵਾਰੀ ਕੋਈ ਤਸਵੀਰ ਹੈ ਜਿਹਦਾ ਉਹਨੇ ਚਿੱਤ ਚਿੱਤਰ ਬਣਾਉਣਾ ਉਸਨੂੰ ਆਪਣੇ ਅੱਖਾਂ ਰਾਹੀਂ ਘੁੰਮਾ ਲਿਆ ਇਹ ਨਹੀਂ ਹੈ ਵਿੱਚੇ ਮੂਹਰੇ ਫੋਟੋ ਰੱਖ ਲਈ ਜਾਂ ਮੂਹਰੇ ਕੋਈ ਚੀਜ਼ ਰੱਖ ਲਈ ਉਹਦਾ ਚਿੱਤਰ ਬਣਾ ਨਾ ਨਾ ਨਾ ਉਹਨੂੰ ਅਸੀਂ ਚਿੱਤਰਕਾਰ ਨਹੀਂ ਕਹਿਦੇ ਚਿੱਤਰਕਾਰ ਤਾਂ ਅਸਲ ਉਹੀ ਆ ਜੋ ਹੂ ਬ ਹੂ ਬਣਾ ਦੇਵੇ ਆਪਣੇ ਅੱਖਾਂ 'ਚ ਦੀ ਇੱਕ ਵਾਰੀ ਦੇਖ ਕਰਕੇ ਜਿਦਾਂ ਕਿ ਪਹਿਲਾਂ ਐਜ਼ ਇੱਟ ਇਜ਼ ਬਣਾਉਂਦੇ ਬਣਾ ਦਿੰਦੇ ਸੀਗੇ ਉਹ ਅਸਲ ਚਿੱਤਰਕਾਰ ਨੇ ਬਾਕੀ ਚਿੱਤਰਕਾਰ ਬਣਨਾ ਹਰ ਇੱਕ ਇੱਕ ਦੇ ਵੱਸ ਦੀ ਗੱਲ ਵੀ ਨਹੀਂ ਹੈ ਉਸਨੂੰ ਬਹੁਤ ਹੁਨਰ ਰੱਖਣਾ ਪੈਂਦਾ ਚਿੱਤਰਕਾਰੀ ਬਣਾਉਣ ਵਾਸਤੇ ਸਿੱਖਣ ਵਾਸਤੇ ਬਹੁਤ ਹਲੀਮੀ ਰੱਖਣੀ ਪੈਂਦੀ ਹੈ ਤਾਂ ਚਿੱਤਰਕਾਰ ਬਣਦਾ ਹੂ ਬ ਹੂ ਜੋ ਬਣਾ ਜਿੱਦਾਂ ਪਹਿਲਾਂ ਮੋਮਨ ਚਿੱਤਰਕਾਰ ਸੀਗੇ ਮੋਮਨ ਦੇ ਚਿੱਤਰਕਾਰ ਬਣਾ ਦਿੰਦੇ ਸੀਗੇ ਉਸ ਤਰ੍ਹਾਂ ਜੇ ਕਿਸੇ ਨੇ ਚਿੱਤਰ ਬਣਾਇਆ ਉਹ ਅਸਲ ਚਿੱਤਰਕਾਰ ਹੋਊਗਾ